ਹੈਲੋ ਸਤਿ ਸ਼੍ਰੀ ਅਕਾਲ ਮੈਂ ਪਿੰਕੀ ਬੋਲਦੀ ਪਈ ਹਾਂ ਇਸਲਾਮਾਬਾਦ ਮਹੱਲੇ ਤੋਂ ਗੁਰਦਾਸਪੁਰ 'ਚੋਂ ਅਤੇ ਪੰਜਾਬ ਵਿੱਚ ਸਿਹਤ ਸ ਸੰਭਾਲ ਲਈ ਸਾਡੇ ਉੱਥੇ ਇੱਕ ਸ ਹੋਸਪਿਟਲ ਸਰਕਾਰੀ ਹੋਸਪਿਟਲ ਖੁੱਲ੍ਹਿਆ ਹੈ ਗਰੀਬਾਂ ਵਾਸਤੇ ਬੜੀਆਂ ਫੈਸਲਿਟੀਆਂ ਹੈਗੀਆਂ ਉੱਥੇ ਗਰੀਬਾਂ ਵਾਸਤੇ ਇੱਥੇ ਲਾਗੇ ਆ ਗਿਆ ਸਰਕਾਰੀ ਹੋਸਪਿਟਲ ਉੱਥੇ ਗਰੀਬਾਂ ਦਾ ਫਰੀ ਚੈੱਕਅਪ ਹੁੰਦਾ ਅਤੇ ਉੱਥੇ ਇਕ ਹੁਣ ਭਗਵੰਤ ਮਾਨ ਨੇ ਵੀ ਖੋਲ੍ਹਿਆ ਆ ਅਤੇ ਉੱਥੇ ਮਤਲਬ ਕਿ ਬੜੀ ਫੈਸਿਲਿਟੀ ਆ ਹੁਣ ਸਾਡੇ ਇੱਥੇ ਕਾਟ ਬਣੇ ਹੈ ਇਹ ਇਸ਼ ਇਸ਼ਰਮ ਕਾਟ ਬਣੇ ਹੈ ਉਹ ਵੀ ਲੋਕਾਂ ਵਾਸਤੇ ਫਰੀ ਅਤੇ ਇਸ਼ਰਮ ਕਾਰਡ ਬਣੇ ਨਾਲ ਉਹ ਦਵਾਈ ਵਾਲੇ ਕਾਟ ਬਣੇ ਆ ਉੱਥੇ ਦੇ ਹੋਸਪਿਟਲ ਦੇਣ ਵਾਸਤੇ ਅਤੇ ਉੱਥੇ ਮੁਫਤ ਇਲਾਜ ਹੁੰਦਾ ਸਾਡੇ ਇੱਥੇ ਅਤੇ ਸਰਕਾਰ ਨੇ ਬਹੁਤ ਜ਼ਿਆਦਾ ਫੈਸਿਲਿਟੀਆਂ ਦਿੱਤੀਆਂ ਗਰੀਬਾਂ ਵਾਸਤੇ ਫਰੀ ਇਲਾਜ ਸਰਕਾਰੀ ਹੋਸਪਿਟਲ ਵਾਲਿਆਂ ਨੇ ਬਹੁਤ ਜ਼ਿਆਦਾ ਮਤਲਬ ਕਿ ਲੋਕਾਂ ਦੀ ਮਦਦ ਵਾਸਤੇ ਸਰਕਾਰ ਨੇ ਫਰੀ ਹੋਸਪਿਟਲ ਹੋਸਪ ਫਰੀ ਹੋਸਪਿਟਲ ਵਿੱਚ ਬਹੁਤ ਜ਼ਿਆਦਾ ਗਰੀਬਾਂ ਵਾਸਤੇ ਫੈਸਿਲਿਟੀਆਂ ਰੱਖੀਆਂ ਹੈਗੀਆਂ ਹੈ